ਹੈਲੋ ਸਤਿ ਸ਼੍ਰੀ ਅਕਾਲ ਜੀ ਵਧੀਆ ਤੁਸੀਂ ਸੁਣਾਓ ਕੀ ਤੁਹਾਡਾ ਕੀ ਹਾਲ ਆ ਸਾਡੀ ਫ਼ਸਲ ਤਾਂ ਬਹੁਤ ਚੰਗੀ ਹੋਈ ਹੈ ਹਰੀ ਭਰੀ ਹੈ ਇਹ ਤਾਂ ਬੜਾ ਬੁਰਾ ਹੋਇਆ ਚਲੋ ਮੈਂ ਸਾਡੀ ਮੈਂ ਇਸ ਵਾਰ ਗ੍ਰੀਨ ਰੈਵੋਲੂਸ਼ਨ ਮੈਥਡ ਯੂਜ ਕੀਤਾ ਜਿਸ ਦੇ ਵਿੱਚ ਮੇਰੀ ਫ਼ਸਲ ਬਹੁਤ ਹੀ ਚੰਗੀ ਹੋਈ ਹੈ ਤੁਹਾਨੂੰ ਪਤਾ ਹੀ ਹੋਏਗਾ ਕਿ ਗਰੀਨ ਰੈਵੋਲੂਸ਼ਨ ਉੱਨੀ ਸੌ ਸੱਠ ਵਿੱਚ ਆਇਆ ਇਸ ਵਿੱਚ ਨਵੀਂ ਨਵੀਂ ਟੈਕਨੋਲੋਜੀਆਂ ਮਸ਼ੀਨਾਂ ਯੂਜ ਕੀਤੀਆਂ ਜਾਂਦੀਆਂ ਜਿਹਦੇ ਨਾਲ਼ ਸਾਡੀ ਫ਼ਸਲ ਜੋ ਕਿ ਆ ਜਲਦ ਤੋਂ ਜਲਦ ਉੱਗਦੀ ਹੈ ਅਤੇ ਬਹੁਤ ਜਲਦ ਸਮੇਂ ਵਿੱਚ ਉੱਗ ਜਾਂਦੀਆਂ ਹਨ ਅਤੇ ਕੀੜੇ ਮਾਰਨ ਵਾਲੀਆਂ ਦਵਾਈਆਂ ਵੀ ਹਾਂ ਹਾਂ ਚਲੋ ਠੀਕ ਹੈ ਫਿਰ ਸਤਿ ਸ਼੍ਰੀ